ਮੈਂ ਪੰਜਾਬ ਦੇ ਇੱਕ ਜ਼ਿਲ੍ਹੇ ਮੋਹਾਲੀ ਦੀ ਰਹਿਣ ਵਾਲੀ ਹਾਂ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਅਤੇ ਇਹ ਪੰਜਾਬ ਦੇ ਹਰ ਇੱਕ ਖੇਤਰ ਵਿੱਚ ਬੋਲੀ ਜਾਂਦੀ ਹੈ ਜਿਵੇਂ ਕਿ ਬੈਕਾਂ ਵਿੱਚ ਸਕੂਲਾਂ ਵਿੱਚ ਕਾਲਜਾਂ ਵਿੱਚ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਲਾਜ਼ਮੀ ਹੈ ਅਤੇ ਮੈਂ ਆਪਣੀ ਮਾਂ ਬੋਲੀ 'ਤੇ ਮਾਨ ਕਰਦੀ ਹਾਂ